ਜਿਵੇਂ ਕਿ ਗਾਇਕੀ ਮੇਰਾ ਫੇਵਰਟ ਪੈਸ਼ਨ ਹੈ ਅਤੇ ਜੋ ਗਾਇਕੀ ਹੈ ਇਸ ਵਿੱਚ ਮੇਰੀਆਂ ਜੋ ਭਾਵਨਾਵਾਂ ਹਨ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਕਿਉਂਕੀ ਇਹ ਇਹ ਜੋ ਭਾਵਨਾਵਾਂ ਹਨ ਇਹ ਮਤਲਬ ਉਸ ਸਮੇਂ ਨਿਕਲਦੀਆਂ ਹਨ ਜਿਸ ਸਮੇਂ ਮੈਂ ਗਾਇਕੀ ਕਰਦੀ ਹਾਂ ਜਾਂ ਮੈਨੂੰ ਬਹੁਤ ਮਤਲਬ ਇਹ ਜੋ ਭਾਵਨਾਵਾਂ ਹਨ ਇਹ ਫੇਸ ਐਕਸਪ੍ਰੈਸ਼ਨਸ ਅਤੇ ਬੋਡੀ ਐਕਸਪ੍ਰੈਸ਼ਨਸ ਦੇ ਜ਼ਰੀਏ ਨਿਕਲਦੀਆਂ ਹਨ ਜਿਸ ਨੂੰ ਸਾਹਮਣੇ ਵਾਲਾ ਦੇਖ ਕੇ ਵੀ ਪ੍ਰਚਲਿਤ ਹੁੰਦਾ ਹੈ ਅਤੇ ਮਤਲਬ ਜਾਗਰੂਕ ਹੁੰਦਾ ਹੈ ਕਿ ਜਿਸ ਹਿਸਾਬ ਦਾ ਆਪਾਂ ਸੰਗੀਤ ਸੁਣਦੇ ਹਾਂ ਜਾਂ ਆਪਾਂ ਗਾਇਕੀ ਕਰਦੇ ਹਾਂ ਉਸ ਨਾਲ ਆਪਾਂ ਦੇ ਆਪਣੇ ਅੰਦਰ ਵੀ ਭਾਵਨਾਵਾਂ ਪ੍ਰਗਟ ਹੁੰਦੀਆਂ ਹਨ ਅਤੇ ਉਸ ਭਰਾ ਭਾਵਨਾਵਾਂ ਨੂੰ ਆਪਾਂ ਕੰਟੈਸਟੈਂਟ ਦੇ ਅੱਗੇ ਅਤੇ ਔਡੀਐਂਸ ਦੇ ਅੱਗੇ ਪੇਸ਼ ਕਰਦੇ ਹਾਂ ਇਹ ਕੰਟੈਸਟੈਂਟ ਨੂੰ ਵੀ ਪਤਾ ਹੁੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਗਾਣਾ ਗਾ ਰਹੇ ਹਾਂ ਅਤੇ ਅਤੇ ਅਸੀਂ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਔਡੀਐਂਸ ਦੇ ਅੱਗੇ ਪੇਸ਼ ਕਰਨੀਆਂ ਹਨ ਤਾਂ ਉਹ ਮੇਰੇ ਲੀਏ ਤਾਂ ਜੋ ਗਾਇਕੀ ਹੈ ਉਸ ਵਿੱਚ ਮੇਰੀਆਂ ਭਾਵਨਾਵਾਂ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ